ਹੈਲੋ ਹਾਂਜੀ ਸਤਿ ਸ੍ਰੀ ਅਕਾਲ ਮੈਮ ਹਾਂਜੀ ਹਾਂਜੀ ਮੈਮ ਹਾਂਜੀ ਦੱਸੋ ਹਾਂਜੀ ਲੁਧਿਆਣਾ ਹੈ ਨਾ ਅੰਮ੍ਰਿਤਸਰ ਬਾਕੀ ਦਿੱਲੀ ਮੁੰਬਈ ਹਨ ਸਾਰੇ ਇੱਥੇ ਸਾਰੇ ਆਉਂਦੇ ਹੈ ਜੀ ਹਾਂਜੀ ਹਾਂਜੀ ਹਾਂਜੀ ਹੈ ਕੁਲੀ ਹੈ ਹਾਂਜੀ ਉਹ ਵੀ ਅੱਛੀ ਤਰ੍ਹਾਂ ਆਉਂਦੇ ਤੁਹਾਡੇ ਨਾਲ ਅੱਛੀ ਤਰ੍ਹਾਂ ਹਾਂਜੀ ਸਫ਼ਾਈ ਲਈ ਵੀ ਅਸੀਂ ਵਰਕਰ ਰੱਖੇ ਹੋਏ ਹੈ ਸਫ਼ਾਈ ਤਾਂ ਅਸੀਂ ਬਿਲਕੁਲ ਕਰਵਾ ਕੇ ਰੱਖਦੇ ਆ ਜ਼ਿਆਦਾ ਤਾਂ ਸ਼ੁੱਧ ਹੀ ਰੱਖਦੇ ਹਾਂ ਇੱਥੇ ਹਾਂਜੀ ਹਾਂਜੀ ਹਾਂਜੀ ਬਿਲਕੁਲ ਸਾਫ਼ ਸੁਥਰਾ ਹਾਂਜੀ ਹਾਂਜੀ ਹਾਂਜੀ ਹੈਗਾ ਹੈ ਜੀ ਤੁਸੀਂ ਕਿੱਥੇ ਜਾਣਾ ਹੈ ਜੀ ਵੈਸੇ ਤੁਸੀਂ ਪੁੱਛ ਰਹੇ ਹੋ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਬਿਲਕੁਲ ਆਪਾਂ ਅੱਛੀ ਤਰ੍ਹਾਂ ਪ੍ਰੋਵਾਈਡ ਕੀਤਾ ਹੋਇਆ ਹੈ ਜੀ ਸਫ਼ਾਈ ਵੀ ਵਧੀਆ ਪ੍ਰੋਵਾਈਡ ਕਰਦੇ ਹਾਂ ਸਫ਼ਾਈ ਲਈ ਵੀ ਵਰਕਰ ਰੱਖੇ ਹੋਏ ਹੈ ਕੁਲੀ ਵੀ ਉਪਲੱਬਧ ਹੈ ਹਾਂਜੀ ਹਾਂਜੀ ਹਾਂਜੀ ਆਪਾਂ ਕੁਲੀ ਵੀ ਉਪਲੱਬਧ ਕੀਤਾ ਹੋਇਆ ਹਾਂਜੀ ਠੀਕ ਹੈ ਜੀ ਓਕੇ ਜੀ ਓਕੇ